ਸਿੱਖਿਆ ਦਾ ਪ੍ਰਣਾਲੀ ਬਹੁਤ ਵਧੀਆ ਵਾ ਕਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਕਿਹੜੇ ਲੋਕ ਆ ਜ਼ਿਆਦਾਤਰ ਸਕੂਲਾਂ 'ਚ ਪੜ੍ਹੇ ਜਾਂਦੇ ਆ ਬਹੁਤ ਸਟੱਡੀ ਹੁੰਦੀ ਆ ਕਿੱਦਾਂ ਆਪਾਂ ਪੇਂਡੂ ਖੇਤਰਾਂ ਦੀ ਗੱਲ ਕਰੀਏ ਜੇ ਪੇਂਡੂਆਂ ਤਰ੍ਹਾਂ ਜੇ ਸਰਕਾਰੀ ਸਕੂਲ ਨੇ ਕਿਹੜੇ ਉਹਨਾਂ ਨੂੰ ਅੱਜ ਕੱਲ੍ਹ ਸਰਕਾਰ ਹੈ ਕਿਹੜਾ ਐਲੀਮੈਂਟ ਬਣਾਉਣ ਦੀ ਆ ਕਿੱਦਾਂ ਹੁਣ ਮੈਂ ਆਪ ਇੱਕ ਸਰਕਾਰੀ ਸਕੂਲ 'ਚ ਪੜ੍ਹਣ ਦਿਆਂਵਾਂ ਅਤੇ ਸਾਡੇ ਸਕੂਲ 'ਚ ਸਰਕਾਰੀ ਸਕੂਲ 'ਚ ਕੰਪਿਊਟਰ ਲੈਬ ਵੀ ਹੈਗੀ ਆ ਸਰਕਾਰ ਨੂੰ ਚਾਹੀਦਾ ਵਾ ਕਿ ਆਹ ਜਿਹੜੇ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਕੰਪਿਊਟਰਸ ਹੋ ਗਏ ਟੀਚਰ ਹੋ ਗਏ ਜਾਂ ਗੇਮ ਗੇਮਸ ਹੋ ਗਈਆਂ ਗੇਮਸ ਹੋ ਗਈਆਂ ਅਤੇ ਉਹਨਾਂ ਨੂੰ ਆਪਾਂ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਵਾ ਅਤੇ ਆਪਣੇ ਕਿਹੜੇ ਲੋਕ ਆ ਪੇਂਡੂ ਆ ਪੇਂਡੂ ਲੋਕ ਆ ਪੇਂਡੂ ਖੇਤਰਾਂ 'ਚ ਜਿਹੜੀ ਸਿੱਖਿਆ ਉਹ ਬਹੁਤ ਹੀ ਜ਼ਿਆਦਾ ਹੁੰਦੀ ਆ ਅਤੇ ਪਰ ਅੱਜ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਸ਼ਹਿਰਾਂ ਨਾਲੋਂ ਜ਼ਿਆਦਾ ਲੋਕ ਪਿੰਡ 'ਚ ਰਹਿੰਦੇ ਨੇ ਅਤੇ ਪਿੰਡ 'ਚ ਪੜ੍ਹਾਈ ਵੀ ਬਹੁਤ ਵਧੀਆ ਵਾ ਉਹਨਾਂ ਦੇ ਕਿਹੜੇ ਸਕੂਲ ਆ ਐਲੀਮੈਂਟ ਸਕੂਲ ਆ ਐਲੀਮੈਂਟ ਸਕੂਲਾਂ 'ਚ ਆਪਾਂ ਨੂੰ ਹੁਣ ਆਪਾਂ ਮੰਨੀਏ ਕਿ ਆਹ ਜਿਹੜੇ ਹੁਣ ਸਰਕਾਰ ਹੈ ਇੰਨੀ ਐਲੀਮੈਂਟ ਸਕੂਲ ਬਣਾਏ ਆ ਐਲੀਮੈਂਟ ਸਕੂਲਾਂ 'ਚ ਕਿੱਦਾਂ ਬੋਆਏਸ ਗਰਲਸ ਇਕੱਠੇ ਹੋ ਗਏ ਆ ਉਹਨਾਂ ਨੂੰ ਕੰਪਿਊਟਰ ਲੈਬ ਦਿੱਤੀ ਹੈ ਸਾਇੰਸ ਲੈਬ ਦਿੱਤੀ ਹੈ ਪ੍ਰੋਜੈਕਟਰ ਰੂਮ ਦਿੱਤਾ ਵਾ ਮੈਂ ਵੀ ਸਰਕਾਰੀ ਸਕੂਲ ਆ ਅਤੇ ਸਾਡੇ ਸਕੂਲ 'ਚ ਬਹੁਤ ਸਾਰੇ ਬਦਲਾਅ ਹੋ ਗਏ ਆ ਕਿੱਦਾਂ ਕਿ ਸਾਡੇ ਸਕੂਲ 'ਚ ਪ੍ਰੋਜੈਕਟ ਰੂਮ ਬਣ ਗਏ ਸਾਇੰਸ ਲੈਬ ਬਣ ਗਈ ਕੰਪਿਊਟਰ ਲੈਬ ਬਣ ਗਈ ਆ ਆਪਾਂ ਕਹੀਏ ਤਾਂ ਆਪਾਂ ਨੂੰ ਬਹੁਤ ਹੀ ਵਧੀਆ ਵਾ ਕਿਹੜੇ ਸਰਕਾਰੀ ਸਕੂਲਾਂ 'ਚ ਅੱਜ ਕ ਪਹਿਲਾਂ ਨਾਲੋਂ ਜ਼ਿਆਦਾ ਬਦਲਾਅ ਹੋ ਗਿਆ ਵਾ ਅਤੇ ਆਪਾਂ ਨੂੰ ਸਿੱਖਿਆ ਪ੍ਰਣਾਲੀ ਦੋਵੇਂ ਪੜ੍ਹਨਾ ਚਾਹੀਦਾ ਵਾ ਪੜ੍ਹਨਾ ਚਾਹੀਦਾ ਬਿਹਤਰ ਵੀ ਬਣਾ ਤਾ ਵਾ ਪੜ੍ਹਾਈ ਨੂੰ ਪਰ ਆਹ ਵਾ ਕਿ ਇਹੀ ਸਕੂਲਾਂ 'ਚ ਟੀਚਰ ਨਹੀਂ ਹੈਗੇ ਸਰਕਾਰ ਨੂੰ ਕਰਨਾ ਚਾਹੀਦਾ ਕਿ ਉਹ ਸਕੂਲ 'ਚ ਟੀਚਰ ਭੇਜਣ ਟੀਚਰ ਭੇਜਣ ਅਤੇ ਆਪਾਂ ਨੂੰ ਸਾਰੇ ਜਿਹੜੇ ਬੱਚੇ ਉਹ ਪੜ੍ਹ ਸਕਣ ਲਿਖ ਸਕਣ